ਮੇਰੇ ਦਾਦਾ ਦਾਦੀ ਅਤੇ ਮਾਤਾ ਪਿਤਾ ਦੋਨੋਂ ਹੀ ਸਿੱਖਿਆ ਵਜੋਂ ਵਾਂਝੇ ਰਹੇ ਹਨ ਕਿਉਂਕਿ ਇੱਕ ਤਾਂ ਉਹਨਾਂ ਦਾ ਸੰਬੰਧ ਗਰੀਬ ਪਰਿਵਾਰ ਨਾਲ ਸੀ ਉਸ ਤੋਂ ਇਲਾਵਾ ਉਹ ਕਿਸਾਨੀ ਕਰਦੇ ਸੀ ਮੁੱਖ ਤੌਰ 'ਤੇ ਕਿਸਾਨੀ ਵਾਲੇ ਪਰਿਵਾਰ ਆ ਉਹਨਾਂ ਕੋਲ ਇੰਨਾ ਸਮਾਂ ਹੀ ਨਹੀਂ ਹੁੰਦਾ ਕਿ ਉਹ ਕੋਈ ਸਿੱਖਿਆ ਪ੍ਰਾਪਤ ਕਰ ਸਕਣ ਉਸ ਸਮੇਂ ਪੁਰਾਣੇ ਸਮੇਂ ਦੇ ਵਿੱਚ ਸਿੱਖਿਆ ਦਾ ਪ੍ਰਬੰਧ ਵੀ ਇੰਨਾ ਮਾੜਾ ਸੀ ਕਿ ਸਭ ਨੂੰ ਸਿੱਖਿਆ ਨਹੀਂ ਮਿਲ ਸਕਦੀ ਸੀ ਸੋ ਮੇਰੇ ਦਾਦਾ ਦਾਦੀ ਅਤੇ ਮਾਤਾ ਪਿਤਾ ਦੀ ਸਿੱਖਿਆ ਬਹੁ ਨਾ ਮਾਤਰ ਹੀ ਹੈ ਅਤੇ ਦਾਦਾ ਦਾਦੀ ਤਾਂ ਬਿਲਕੁਲ ਨਹੀਂ ਪੜ੍ਹੇ ਮਾਤਾ ਪਿਤਾ ਵੀ ਬਹੁਤ ਘੱਟ ਪੜ੍ਹੇ ਹਨ ਦੋਨਾਂ ਦੋਨਾਂ ਨੂੰ ਹੀ ਸਿੱਖਿਆ ਦੇ ਮੌਕੇ ਉਹ ਨਹੀਂ ਮਿਲੇ ਕਿਉਂਕਿ ਇੱਕ ਪਰਿਵਾਰ ਵੱਡਾ ਸੀ ਦੂਜਾ ਘਰ ਦੇ ਗੁਜ਼ਾਰੇ ਲਈ ਖੇਤੀ ਉੱਪਰ ਨਿਰਭਰ ਹੋਣਾ ਪੈਂਦਾ ਸੀ ਖੇਤੀ ਉੱਪਰ ਨਿਰਭਰ ਹੋਣ ਦੇ ਨਾਲ ਨਾਲ ਉਹ ਬਹੁਤ ਸਾਰੀ ਖੇਤੀ ਹਿੱਸੇ ਠੇਕੇ 'ਤੇ ਲੈ ਕੇ ਵੀ ਕਰਦੇ ਸੀ ਸੋ ਉਹ ਸਿੱਖਿਆ ਤੋਂ ਵਾਂਝੇ ਰਹਿ ਗਏ ਹੁਣ ਵੀ ਬਾ ਜ਼ਿਆਦਾ ਜਿਹੜਾ ਸੁਧਾਰ ਉਹ ਨਹੀਂ ਆਇਆ ਹੈ ਹੁਣ ਦੇ ਸਮੇਂ ਦੇ ਵਿੱਚ ਚਾਹੇ ਮੇਰੀਆਂ ਭੈਣਾਂ ਜਾਂ ਮੇਰੇ ਭਰਾ ਜ਼ਰੂਰ ਥੋੜ੍ਹਾ ਥੋੜ੍ਹਾ ਪੜ੍ਹ ਚੁੱਕੇ ਹਨ ਅਤੇ ਉਹਨਾਂ ਵਿੱਚੋਂ ਮੈਂ ਸਭ ਤੋਂ ਜ਼ਿਆਦਾ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਹੁਣ ਮੈਂ ਯੂਨੀਵਰਸਿਟੀ ਦੇ ਵਿੱਚ ਪੀਐਚਡੀ ਤੱਕ ਦੀ ਪੜ੍ਹਾਈ ਕਰ ਰਿਹਾ ਹਾਂ